ਮੈਂ ਆਪਣੇ ਭਰਾ ਦੇ ਪਾਸਪੋਰਟ ਦੇ ਲਈ ਅਰਜੀ ਦਿੱਤੀ ਵੀ ਮੇਰੇ ਜਨਮ ਦੇ ਸਰਟੀਫਿਕੇਟ ਦੀ ਜਰੂਰਤ ਹੈ ਪਰ ਮੈਂ ਉਹਦਾ ਮੇਰਾ ਸਰਟੀਫਿਕੇਟ ਉਹਦਾ ਸਰਟੀਫਿਕੇਟ ਕਿਸੀ ਲੋਕਰ ਦੇ ਵਿੱਚ ਪਿਆ ਹੋਇਆ ਮੈਂ ਉਸ ਨੂੰ ਕਹਿ ਰਹੀ ਆ ਕਿ ਤੂੰ ਆ ਕੇ ਇਹਦੇ ਕੋਲੋਂ ਸਰਟੀਫਿਕੇਟ ਲੈਣਾ ਉਹ ਕਹਿ ਰਿਹਾ ਕਿ ਨਹੀਂ ਜਲਦੀ ਹੈ ਤਾਂ ਤੂੰ ਆ ਕੇ ਦੇ ਜਾ ਪਾਸਪੋਰਟ ਦੀ ਅਰਜੀ ਲੈ ਜਾ ਹੋਰ ਵੀ ਕਿਸੇ ਦਸਤਾਵੇਜ ਦੀ ਜਰੂਰਤ ਹੁੰਦੀ ਹੈ ਤਾਂ ਉਹਨੂੰ ਪੁੱਛ ਲੈਦੇ ਹਾਂ ਕਿ ਤੈਨੂੰ ਜੇ ਕਿਸੇ ਹੋਰ ਵੀ ਦਸਤਾਵੇਜ ਦੀ ਜਰੂਰਤ ਹੈ ਤਾਂ ਤੂੰ ਮੇਰੇ ਕੋਲੋਂ ਆ ਕੇ ਜਾਂ ਮੈਨੂੰ ਦੱਸ ਦੇ ਕਿ ਮੈਂ ਆ ਜਾਵਾਂ ਤੂੰ ਆ ਕੇ ਲੈ ਲਾ ਸਰਟੀਫਿਕੇਟ ਤੋਂ ਇਲਾਵਾ ਹੋਰ ਵੀ ਕਈ ਹੋਰ ਵੀ ਕਈ ਹੋਰ ਵੀ ਡਾਕੂਮੈਂਟ ਦੀ ਜਰੂਰਤ ਪੈ ਜਾਂਦੇ ਹਾਂ ਇਹ ਨਾ ਹੋਵੇ ਮੁਸ਼ਕਿਲ ਹੋਵੇ ਜਿਸ ਕਾਰਨ ਉਹ ਮੁਸ਼ਕਲ ਦਾ ਪਾਸਪੋਰਟ ਨਾ ਬਣੇ ਪਾਸਪੋਰਟ ਦੇ ਲਈ ਉਹਨੂੰ ਹੋਰ ਵੀ ਕੋਈ ਕਾਗਜ ਪੱਤਰ ਚਾਹੀਦਾ ਹੈ ਤਾਂ ਮੈਂ ਉਹਨੂੰ ਆਪਣੇ ਲੋਕਰ ਦੇ ਵਿੱਚ ਦੇ ਦਿੰਦੀ ਹਾਂ ਮੈ ਉਹਨੂੰ ਫੋਟੋ ਭੇਜ ਕੇ ਪੁੱਛ ਲਿੰਦੀ ਹਾਂ ਕਿ ਉਹਨੂੰ ਕੀ ਕੁਝ ਚਾਹੀਦਾ ਹੈ ਉਹ ਮੈਨੂੰ ਦੱਸ ਦਵੇ ਵੀ ਮੈਨੂੰ ਆਹ ਆਹ ਸਮਾਨ ਚਾਹੀਦਾ ਹੈ ਜਿਸ ਕਾਰਨ ਉਹ ਮੈ ਉਹਨੂੰ ਸਾਰੇ ਹੀ ਡੀਜੀ ਲਾਕਰ ਦੇ ਵਿੱਚੋਂ ਜਨਮ ਸਰਟੀਫਿਕੇਟ ਤੇ ਹੋਰ ਵੀ ਕੋਈ ਕਾਗਜ ਪੱਤਰ ਚਾਹੀਦਾ ਹੈ ਤਾਂ ਮੈਂ ਉਹਨੂੰ ਨਿਕਾਲ ਕੇ ਦੇ ਦਿੱਤਾ ਕੀ ਉਹਦਾ ਪਾਸਪੋਰਟ ਤਿਆਰ ਹੋ ਜਾਵੇ ਜਿਸ ਨਾਲ ਉਹਨੂੰ ਉਹੀ ਮੁਸ਼ਕਿਲ ਨਾਲ ਹੋਵੇ ਮੇਰਾ ਭਰਾ ਬਹੁਤ ਹੀ ਸੋਹਣਾ ਨੀ ਬਹੁਤ ਹੀ ਚੰਗਾ ਹੈਗਾ ਉਹਨੇ ਆਪਣਾ ਕੰਮ ਸ਼ੁਰੂ ਕਰਨ ਲਈ ਬਾਹਰ ਜਾਣ ਦੀ ਇਸ ਲਈ ਦਸਤਾਵੇਜ ਦੀ ਦੀ ਜੋ ਵੀ ਹੋਵੇ ਇਸ ਲਈ ਹੋਵੇ ਧੰਨਵਾਦ